ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਮੈਮ ਸਾਡੇ ਕੋਲ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਜਿਵੇਂ ਤੁਹਾਡੇ ਬੱਚੇ ਦੀ ਉਮਰ ਕਿੰਨੀ ਹੈ ਠੀਕ ਹੈ ਮੈਮ ਉਮਰ ਦੀ ਉਮਰ ਦੇ ਓਕੇ ਠੀਕ ਹੈ ਮੈਮ ਠੀਕ ਹੈ ਜੀ ਮੈਮ ਦੇਖੋ ਉਮਰ ਦੇ ਅਨੁਸਾਰ ਅਸੀਂ ਪੰਦਰਾਂ ਸਾਲ ਦੇ ਬੱਚੇ ਲਈ ਉਹ ਸਿਵ ਸਵਿਮਿੰਗ ਵੀ ਕਰ ਸਕਦਾ ਤੈਰਾਕੀ ਵੀ ਸਿੱਖ ਸਕਦਾ ਆ ਠੀਕ ਹੈ ਡਾਂਸ ਵੀ ਸਿੱਖ ਸਕਦਾ ਆ ਉਹਦੇ ਲਈ ਭੰਗੜਾ ਕਲਾਸਿਸ ਵੀ ਹੈਗੀਆਂ ਆ ਠੀਕ ਹੈ ਅਲੱਗ ਤੋਂ ਜਿੱਦਾਂ ਬੱਚਿਆਂ ਦੇ ਲਈ ਉਸ ਤੋਂ ਇਲਾਵਾ ਬੱਚਾ ਜਿਹੜਾ ਹੈ ਉਹ ਗੇਮਸ ਦੇ ਵਿੱਚ ਵੀ ਜਾ ਸਕਦਾ ਸਾਡੇ ਕੋਲ ਟੇਬਲ ਟੈਨਿਸ ਵੀ ਹੈਗਾ ਜਿੱਦਾਂ ਐਕਟੀਵਿਟੀਜ਼ ਦੇ ਵਿੱਚ ਠੀਕ ਹੈ ਅਤੇ ਤੁਸੀਂ ਉਹਦੇ ਵਿੱਚ ਵੀ ਅਗਰ ਉਹ ਗੇਮ ਦੇ ਵਿੱਚ ਉਹਦੀ ਰੁਚੀ ਹੈਗੀ ਆ ਤਾਂ ਠੀਕ ਹੈ ਉਹ ਟੇਬਲ ਟੈਨਿਸ ਦੇ ਵਿੱਚ ਜਾ ਸਕਦਾ ਆ ਹਾਂਜੀ

ਹਾਂਜੀ ਹਾਂਜੀ ਮੈਮ ਜਿਵੇਂ ਕਿ ਹੁਣ ਬੱਚਿਆਂ ਨੂੰ ਛੁੱਟੀਆਂ ਨੇ ਅਤੇ ਇਸ ਕਰਕੇ ਸਾਡੇ ਕਲੱਬ ਵੱਲੋਂ ਬੱਚਿਆਂ ਨੂੰ ਇੱਕ ਓਫਰ ਉਹਨਾਂ ਦੇ ਲਈ ਲਗਾਇਆ ਗਿਆ ਆ ਜੇ ਤੁਸੀਂ ਹੁਣ ਸਾਡੇ ਕੋਲੋਂ ਮਤਲਬ ਕਲੱਬ ਦੀ ਇੰਚਾਰਜਸ਼ਿਪ ਲੈਂਦੇ ਹੋ ਠੀਕ ਹੈ ਬੱਚੇ ਨੂੰ ਆਪਣੇ ਨੂੰ ਦਾਖਲਾ ਦਵਾਉਂਦੇ ਹੋ ਤਾਂ ਦੋ ਹਜ਼ਾਰ ਰੁਪਇਆ ਸਾਲ ਦਾ ਲੱਗੇਗਾ ਠੀਕ ਹੈ ਅਤੇ ਇਹਦੇ ਨਾਲ ਇੱਕ ਇਹ ਗੱਲ ਹੋਏਗੀ ਕਿ ਉਹ ਪੂਰੇ ਮਤਲਬ ਲਾਈਫ ਦੇ ਲਈ ਇੱਕ ਮੈਂਬਰ ਬਣ ਜਾਏਗਾ ਸਾਡੇ ਕਲੱਬ ਦਾ ਠੀਕ ਹੈ ਅਗਰ ਤੁਸੀਂ ਮਹੀਨੇ ਮਹੀਨੇ ਦੀ ਫੀਸ ਗੱਲ ਕਰੀਏ ਤਾਂ ਉਹਦੇ ਵੀ ਉਹਦੇ ਵਾਸਤੇ ਤੁਹਾਨੂੰ ਪੰਜ ਸੌ ਰੁਪਇਆ ਦੇਣਾ ਪਏਗਾ ਜਿੱਦਾਂ ਮਹੀਨੇ ਦੀ ਫੀਸ ਹੋਏਗੀ ਠੀਕ ਹੈ ਅਤੇ ਅਗਰ ਤੁਸੀਂ ਇਕੱਠਾ ਕਰਵਾਉਂਦੇ ਹੋ ਤਾਂ ਉਹਦੇ ਵਿੱਚ ਅਸੀਂ ਤੁਹਾਨੂੰ ਇੱਕ ਮਹੀਨੇ ਦੀ ਛੋਟ ਦੇਵਾਂਗੇ ਹਾਂਜੀ ਹਾਂਜੀ ਹਾਂਜੀ ਜਿਹੜੀ ਪੰਦਰਾਂ ਸਾਲ ਦੀ ਬੱਚੇ ਨੇ ਮੈਮ ਉਹ ਅਸੀਂ ਗਿਆਰਾਂ ਵਜੇ ਤੋਂ ਲੈ ਕੇ ਇੱਕ ਵਜੇ ਤੱਕ ਬੁਲਾਏ ਜਾਂਦੇ ਨੇ ਹਾਂਜੀ ਹਾਂਜੀ ਦੋ ਘੰਟੇ ਲਈ ਹੈ ਅਤੇ ਹਾਂਜੀ ਹਾਂਜੀ ਮੈਮ ਸਾਡੇ ਕੋਲ ਪ੍ਰੋਪਰ ਜਿੱਦਾਂ ਟਰੇਨਰ ਹੈਗੇ ਨੇ ਉਹ ਬੱਚਿਆਂ ਨੂੰ ਪ੍ਰੋਪਰ ਗਾਈਡ ਕਰਦੇ ਆ ਸਹੀ ਤਰ੍ਹਾਂ ਗਾਈਡ ਕਰਦੇ ਆ ਉਸ ਉਹਨਾਂ ਨੂੰ ਖੇਡਣਾ ਸਿਖਾਉਂਦੇ ਆ ਅਗਰ ਉਹ ਸਿੱਖ ਰਹੇ ਨੇ ਤਾਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੇ ਵਿੱਚ ਸਿਖਾਇਆ ਜਾਂਦਾ ਹੈ ਆ ਜੇ ਉਹ ਭੰਗੜਾ ਹੈ ਤਾਂ ਉਹਦੇ ਵਾਸਤੇ ਅਲੱਗ ਤੋਂ ਇੱਕ ਕੋਚ ਹੈ ਠੀਕ ਹੈ ਅਤੇ ਤੁਸੀਂ ਇਸ ਐਤਵਾਰ ਨੂੰ ਆ ਆ ਸਕਦੇ ਹੋ ਜਾਂ ਤੁਸੀਂ ਕੱਲ੍ਹ ਵੀ ਆ ਸਕਦੇ ਹੋ ਠੀਕ ਹੈ ਜੀ

ਠੀਕ ਹੈ ਮੈਮ ਓਕੇ